ਹਾਂ ਹਾਂਜੀ ਮੈਮ ਨਮਸਕਾਰ ਮੈਮ ਮੈਂ ਤੁਹਾਡੀ ਦੁਕਾਨ ਤੋਂ ਨਾ ਸਵੇਰੇ ਨਾ ਸੈੱਲ ਲੈ ਕੇ ਗਈ ਸੀ ਅਤੇ ਮੈਂ ਉਹ ਸੈੱਲ ਨਾ ਪੈਕਿੰਗ ਖੋਲ੍ਹ ਲਿਤੀ ਦੀ ਹੈ ਮੈਂ ਉਹ ਆਪਣੇ ਰਿਮੋਟ ਵਿੱਚ ਪਾਏ ਪਰ ਮੇਰੇ ਉਹ ਸੈੱਲ ਵਰਕ ਨਹੀਂ ਕੀਤੇ ਮੇਰਾ ਰਿਮੋਟ ਨਹੀਂ ਚੱਲਿਆ ਅਤੇ ਤੁਸੀਂ ਮੈਨੂੰ ਹਾਂਜੀ ਹਾਂਜੀ ਮੈਂ ਸੈੱਲ ਪਾਏ ਰਿਮੋਟ ਵਿੱਚ ਪਰ ਮੇਰਾ ਰਿਮੋਟ ਜਿਹੜਾ ਆ ਉਹ ਵਰਕ ਨਹੀਂ ਕੀਤਾ ਮੈਂ ਬਹੁਤ ਨਹੀਂ ਮੈਂ ਬਹੁਤ ਵਾਰ ਟਰਾਈ ਕੀਤਾ ਬਟ ਉਹ ਬਿਲਕੁਲ ਵੀ ਵਰਕ ਨਹੀਂ ਕੀਤੇ ਨਹੀਂ ਨਹੀਂ ਉਹ ਘੜੀ ਵਿੱਚ ਵੀ ਵਰਕ ਨਹੀਂ ਕੀਤੇ ਹਾਂਜੀ

ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਚਲੋ ਠੀਕ ਹੈ ਕੁਛ ਦੇ ਦਿਓ ਮਤਲਬ ਮੈਨੂੰ ਰਿਫੰਡ ਹੋ ਜਾਵੇ ਹਾਂਜੀ ਹਾਂਜੀ ਠੀਕ ਹੈ ਓਕੇ ਓਕੇ ਬਾਏ ਓਕੇ ਬਾਏ ਬਾਏ